ਅਸੀਂ ਪਹਿਲਾਂ ਗੜੇ ਰਹਿੰਦੇ ਸੀ ਉੱਥੇ ਇੱਕ ਲੇਡੀਜ ਪੇਟਿੰਗ ਸਿਖਾਉਂਦੀ ਸੀ ਉਹਨਾਂ ਵੱਲ ਮੈਂ ਸਿੱਖੀ ਪੇਟਿੰਗ ਪਹਿਲਾਂ ਮੈਂ ਚੱਦਰਾਂ ਉੱਤੇ ਪੇਟਿੰਗ ਕੀਤੀ ਸੂਟ ਪੇਂਟ ਕੀਤੇ ਅਤੇ ਇੱਕ ਜਿਹੜੀ ਪਾਈਪ ਸੀਵਰੇਜ ਦੇ ਵਿੱਚ ਪੈਂਦੇ ਉਹਨਾਂ ਨੂੰ ਪੇਂਟ ਕਰਕੇ ਉਹਨਾਂ ਦੇ ਗੁਲਾਬ ਦੇ ਫੁੱਲ ਬਣਾਉਣੇ ਕਲੇ ਭਰ ਕੇ ਵਿੱਚ ਗੁਲਾਬ ਦੇ ਫੁੱਲ ਬਣਾਉਣੇ ਉਹਨਾਂ ਨੂੰ ਪੇਂਟ ਕਰਨਾ ਅਤੇ ਉੱਤੇ ਗਮਲੇ ਬਨ ਰੱਖਣੇ ਅਤੇ ਫਿਰ ਮੈਂ ਫੁੱਲ ਵੀ ਬਣਾਉਣੇ ਸਿੱਖੇ ਸੀ ਉਹਨਾਂ ਕੋਲ ਗਮਲਿਆਂ ਵਿੱਚ ਸਜਾਵਟ ਕਰਨ ਲਈ ਅਤੇ ਫਿਰ ਮੈਂ ਇੱਕ ਐਲਮੀਨੀਅਮ ਦੇ ਉੱਤੇ ਘੋੜਿਆਂ ਦੀ ਪੇਂਟਿੰਗ ਬਣਾਈ ਉਹਨੂੰ ਉੱਭਰਵੇ ਕਰਕੇ ਸੂਏ ਨਾਲ ਮੋਰੀਆਂ ਕਰਕੇ ਉਹਨੂੰ ਉਭਾਰਿਆ ਅਤੇ ਉਹਨਾਂ 'ਤੇ ਪੇਂਟਿੰਗ ਕੀਤੀ ਘੋੜੇ ਚਾਰ ਘੋੜੇ ਬਣਾਏ ਸੀ ਅਤੇ ਉਹਨਾਂ ਦੇ ਲੱਤਾਂ ਵੀ ਬਹੁਤ ਘੱਟ ਦਿਸਦੀਆਂ ਸੀ ਅਤੇ ਚਾਰ ਘੋੜੇ ਸ਼ਕਲ ਹੀ ਦਿਸਦੀ ਸੀ ਉਹਨਾਂ ਦੇ ਉੱਪਰ ਅਤੇ ਮੈਂ ਬਹੁਤ ਲੋਕਾਂ ਦੇ ਬਣਾ ਕੇ ਦਿੱਤੀਆਂ ਸੀ ਉਹ ਪੇਂਟਿੰਗ ਅਤੇ ਉਹ ਮੈਨੂੰ ਬੜੀਆਂ ਪਸੰਦ ਆਈਆਂ ਸੀ ਉਸ ਤੋਂ ਬਾਅਦ ਮੇਰੀ ਰੁਝਾਨ ਘੱਟ ਗਿਆ ਉਹਨਾਂ ਵਿੱਚ ਪੇਂਟਿੰਗ ਦੇ ਵਿੱਚ ਪੇਂਟਿੰਗ ਦੇ ਵਿੱਚ ਰੁਝਾਨ ਮੇਰਾ ਘੱਟ ਗਿਆ ਅਤੇ ਫਿਰ ਮੈਂ ਹੌਲੀ ਹੌਲੀ ਆਪਣੇ ਘਰ ਦੇ ਵਿੱਚ ਹੀ ਰੁੱਝ ਗਈ ਅਤੇ ਫਿਰ ਬੱਚੇ ਮੇਰੇ ਛੋਟੇ ਸੀ ਫਿਰ ਮੈਂ ਘੱਟ ਕੰਮ ਕਰਦੀ ਸੀ ਅਤੇ ਹੌਲੀ ਹੌਲੀ ਫਿਰ ਮੈਂ ਹੁਣ